ਹਾਂਜੀ ਆਪਣੀ ਦੀ ਸਥਿਤੀ ਲਈ ਮੈਂ ਗੈਸ ਏਜੰਸੀ ਵਿੱਚ ਕੋਲ ਕੀਤੀ ਅਤੇ ਆਪਣਾ ਬੁਕਿੰਗ ਰੈਫਰੰਸ ਨੰਬਰ ਅਤੇ ਆਪਣਾ ਆਧਾਰ ਕਾਰਡ 'ਤੇ ਚਾਰ ਅੰਕ ਉਹਨਾਂ ਨੂੰ ਦਿੱਤੇ ਇਸੇ 'ਚ ਉਹਨਾਂ ਨੇ ਮੇਰੇ ਗੈਸ ਸਿਲੰਡਰ ਨੂੰ ਉਸੇ ਸਮੇਂ ਹੀ ਬੁੱਕ ਕਰ ਦਿੱਤਾ ਅਤੇ ਨਾਲ ਡਿਲੀਵਰੀ ਦੀ ਵੀ ਉਸੇ ਦਿਨ ਦੀ ਤਿਥੀ ਪਾ ਦਿੱਤੀ ਅਤੇ ਸਿਲੰਡਰ ਬੁਕਿੰਗ ਆਉਣ ਤੋਂ ਬਾਅਦ ਮੇਰਾ ਸਾਰਾ ਕੰਮ ਸਮੇਂ ਸਿਰ ਹੋ ਗਿਆ ਅਤੇ ਪੈਨਸ਼ਨ ਵੀ ਚੰਗੀ ਤਰ੍ਹਾਂ ਨਿਪਟ ਗਿਆ